ਅਸੀਂ ਘਰ ਵਿੱਚ ਫ਼ਲਦਾਰ ਪੌਦੇ ਵੀ ਲਗਾਉਂਦੇ ਹਾਂ ਅਤੇ ਫੁੱਲਦਾਰ ਵੀ ਲਗਾਉਂਦੇ ਹਾਂ ਪਰ ਇਹਨਾਂ ਦੀ ਸਾਂਭ ਸੰਭਾਲ ਜਿਹੜੀ ਆ ਸਾਨੂੰ ਸਮੇਂ ਸਿਰ ਕਰਨੀ ਪੈਂਦੀ ਹੈ ਹਰ ਜਿਹੜਾ ਪੌਦਾ ਲਗਾਇਆ ਜਾਂਦਾ ਵਾ ਉਹ ਕਿਸੇ ਨਾ ਕਿਸੇ ਮੌਸਮ 'ਤੇ ਜ਼ਰੂਰ ਨਿਰਭਰ ਕਰਦਾ ਵਾ ਜਿਵੇਂ ਕਿ ਗਰਮੀ ਵਿੱਚ ਵੇਖ ਲਓ ਗਰਮੀ ਦੇ ਵਿੱਚ ਜਿਹੜੇ ਆਪਾਂ ਫੁੱਲਦਾਰ ਪੌਦੇ ਲਗਾਉਂਦੇ ਹਾਂ ਉਹਨਾਂ ਦੀ ਸਾਂਭ ਸੰਭਾਲ ਕਰਨ ਦੇ ਲਈ ਸਾਨੂੰ ਕੀ ਆ ਕਿ ਹਰੀ ਜਾਲੀ ਦੇ ਨਾਲ਼ ਢਕਣਾ ਪੈਂਦਾ ਵਾ ਫਿਰ ਕੁਝ ਫੁੱਲ ਅਜਿਹੇ ਹੁੰਦੇ ਆ ਜਿਹਨੂੰ ਪਾਣੀ ਦਾ ਛਿੜਕਾਅ ਕਰਨਾ ਪੈਂਦਾ ਕਈ ਵਾਰੀ ਇੱਦਾਂ ਵੀ ਵੇਖਿਆ ਜਾਂਦਾ ਵਾ ਕਿ ਸੋਕੇ ਦੀ ਸਥਿਤੀ ਵੀ ਆ ਜਾਂਦੀ ਆ ਅਤੇ ਪਾਣੀ ਦੀ ਜਿਹੜੀ ਆ ਪੌਦੇ ਨੂੰ ਨਮੀ ਹੋ ਜਾਂਦੀ ਹੈ ਫਿਰ ਸਾਨੂੰ ਪੰਪ ਦੇ ਨਾਲ਼ ਇਹਨਾਂ ਦੇ ਉੱਪਰ ਪਾਣੀ ਦਾ ਸਪਰੇਅ ਕਰਨਾ ਪੈਂਦਾ ਵਾ ਫਿਰ ਜੇਕਰ ਆਪਾਂ ਠੰਢ ਦੀ ਗੱਲ ਕਰੀਏ ਤਾਂ ਕੁਝ ਪੌਦੇ ਅਜਿਹੇ ਹੁੰਦੇ ਆ ਜਿਹੜੇ ਕੋਰੇ ਦੇ ਨਾਲ਼ ਖ਼ਰਾਬ ਹੋ ਜਾਂਦੇ ਆ ਕੋਰੇ ਤੋਂ ਬਚਾਉਣ ਦੇ ਲਈ ਇਹਨਾਂ ਨੂੰ ਕੀ ਆ ਆਪਾਂ ਨੂੰ ਤਰਪਾਲਾਂ ਦੇ ਨਾਲ਼ ਢਕਣਾ ਪੈਂਦਾ ਵਾ ਬਰਸਾਤ ਦੇ ਕੁਝ ਜਿਹੜੇ ਪੌਦੇ ਹੁੰਦੇ ਆ ਉਹ ਬਰਸਾਤ ਦੇ ਲਈ ਹੀ ਲਾਹੇਵੰਦ ਆ ਅਤੇ ਕਈ ਜਿਹੜੇ ਆ ਕਈ ਪੌਦਿਆਂ ਨੂੰ ਬਰਸਾਤ ਜਿਹੜੀ ਆ ਨੁਕਸਾਨ ਪਹੁੰਚਾਉਂਦੀ ਆ ਫਿਰ ਸਾਨੂੰ ਕੀ ਆ ਪੌਦਿਆਂ ਨੂੰ ਜਿ ਜਿਹੜੀ ਆਪਾਂ ਕਿਆਰੀ ਦੇ ਵਿੱਚ ਲਗਾਉਣਾ ਵਾ ਉਹਦੀ ਢਲਾਣ ਬਣਾਉਣੀ ਪੈਂਦੀ ਆ ਤਾਂ ਜੋ ਬਾਰਿਸ਼ ਜ਼ਿਆਦਾ ਹੋਵੇ ਅਤੇ ਜਿਹੜਾ ਮੀਂਹ ਦਾ ਪਾਣੀ ਆਪਣੇ ਆਪ ਹੀ ਬਾਹਰ ਨਿਕਲਜੇ ਨਹੀਂ ਤਾਂ ਜੇਕਰ ਪਾਣੀ ਖਲੋਤਾ ਰਹੂਗਾ ਅਤੇ ਫਿਰ ਜਿਹੜੀ ਆ ਉਹਦੀ ਜੜ੍ਹ ਜਿਹੜੀ ਆ ਉਹ ਗਲਣਾ ਸ਼ੁਰੂ ਹੋ ਜਾਂਦੀ ਆ